ਹਰੇਕ ਮਤਲਬ ਪੰਜਾਬ ਵਿੱਚ ਮਤਲਬ ਹਰੇਕ ਤਰ੍ਹਾਂ ਦੀ ਜਿੱਥੇ ਪੋਜ਼ਟੀਵਿਟੀ ਹੈਗੀ ਉੱਥੇ ਨੈਗਟੀਵਿਟੀ ਵੀ ਹੈਗੀ ਨਾ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ ਨਾ ਮਤਲਬ ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਲੋਕ ਆ ਜਿਹੜੇ ਪਾਏ ਜਾਂਦੇ ਆ ਹੈ ਨਾ ਪਰ ਜਿਹੜਾ ਜਿਹੜਾ ਮੈਨੂੰ ਪੰਜਾਬ 'ਚ ਇਹਨਾਂ ਨੇ ਹੈਰਾਨ ਕੀਤਾ ਉਹ ਕੀਤਾ ਸਭ ਤੋਂ ਵੱਧ ਬੇਰੁਜ਼ਗਾਰੀ ਅਤੇ ਸਭ ਤੋਂ ਵੱਧ ਨਸ਼ਾ ਆ ਜਿਹੜਾ ਚਿੱਟਾ ਸਾਡੇ ਪੰਜਾਬ 'ਚ ਮਤਲਬ ਘੁਣ ਵਾਗੂੰ ਲੱਗਿਆ ਹੋਇਆ ਸ ਚਿੱਟਾ ਸਾਡੇ ਪੰਜਾਬ ਨੂੰ ਨਾ ਇਹ ਚਿੱਟੇ ਦੇ ਬਹੁਤ ਜ਼ਿਆਦਾ ਨੁਕਸਾਨ ਆ ਅਤੇ ਦੂਜਾ ਗੱਲ ਬੇਰੁਜ਼ਗਾਰੀ ਸਭ ਤੋਂ ਵੱਡਾ ਹੈ ਬੇਰੁਜ਼ਗਾਰੀ ਜੇ ਬੇਰੁਜ਼ਗਾਰੀ ਹੈਗੀ ਹੈ ਮਤਲਬ ਕਿਸੇ ਕੋਲ ਕੋਈ ਰੁਜ਼ਗਾਰ ਨਹੀਂ ਹੈ ਨਾ ਤਾਂ ਮਤਲਬ ਚਿੱਟੇ 'ਤੇ ਲੱਗ ਜਾਂਦਾ ਚਿੱਟਾ ਨਸ਼ੇ ਦਾ ਚਿੱਟੇ ਤੋਂ ਬਾਅਦ ਮਤਲਬ ਨਸ਼ੇ ਨਸ਼ੇ ਕਰਦਾ ਕਰਦਾ ਬੰਦਾ ਚੋਰੀਆਂ ਦੇ ਵੀ ਪੈ ਜਾਂਦਾ ਹੈ ਨਾ ਅਤੇ ਮੈਂ ਤਾਂ ਸਭ ਤੋਂ ਵੱਡਾ ਜਿਹੜਾ ਪੰਜਾਬ ਹੈ ਤਾਂ ਮੈਨੂੰ ਚਿੱਟੇ ਨੇ ਬਹੁਤ ਜ਼ਿਆਦਾ ਮਤਲਬ ਉਹ ਕੀਤਾ ਕਾਫੀ ਮੇਰੇ ਯਾਰ ਦੋਸਤ ਹੈਗੇ ਆ ਮਤਲਬ ਹੈ ਨਾ ਜੋ ਇਸ ਜਿਹੜਾ ਨਸ਼ਾ ਚਿੱਟੇ ਦੀ ਜਾਂ ਨਸ਼ੇ ਦੀ ਕਹਿ ਲਉ ਉਹ ਭੇਂਟ ਚੜ੍ਹੇ ਹੈ ਅਤੇ ਜਿਹੜਾ ਉਹ ਆਪਦੀ ਦੁਨੀਆ ਤੋਂ ਦੁਨੀਆ ਤੋਂ ਮਤਲਬ ਚਲੇ ਗਏ ਆ ਹੈ ਨਾ ਮਤਲਬ ਅਤੇ ਦੂਸਰੀ ਗੱਲ ਕੀ ਹੈ ਬੇਰੁਜ਼ਗਾਰੀ ਬੇਰੁਜ਼ਗਾਰੀ ਨੂੰ ਮਤਲਬ ਇੰਨੇ ਕੁ ਗੰਭੀਰ ਮਸਲੇ ਪੈਦਾ ਕਰਤੇ ਨਾ ਅਤੇ ਬੰਦਾ ਜਿਹੜਾ ਸੋਚਣ ਨੂੰ ਮਤਲਬ ਉਹ ਕਰ ਸਕਦੇ ਹੈ ਮਜ਼ਬੂਰ ਕਰਤਾ ਸੋਚਣ ਨੂੰ ਵੀ ਪੰਜਾਬ ਇਹਨਾਂ ਚੀਜ਼ਾਂ 'ਤੇ ਵੀ ਪਹੁੰਚ ਸਕਦਾ ਸੀ